ਪਾਣੀ ਦਾ ਸਾਡੀ ਜ਼ਿੰਦਗੀ 'ਚ ਇੱਕ ਮਹੱਤਵਪੂਰਨ ਸਥਾਨ ਹੈ ਬਿਨਾ ਪਾਣੀ ਤੋਂ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਜੇ ਤਾਂ ਸਾਡਾ ਜੀਵਨ ਅਸੰਭਵ ਹੋ ਜਾਵੇਗਾ ਸਾਡੇ ਦਿਨ ਦੀ ਸ਼ੁਰੂਆਤ ਹੀ ਪਾਣੀ ਤੋਂ ਹੁੰਦੀ ਹੈ ਅਸੀਂ ਸਵੇਰੇ ਉੱਠ ਕੇ ਵੀ ਪਾਣੀ ਪੀਣਾ ਹੀ ਪਸੰਦ ਕਰਦੇ ਹਾਂ ਅਤੇ ਜਦੋਂ ਸਵੇਰੇ ਇਸ਼ਨਾਨ ਕਰਨਾ ਉਦੋਂ ਸਾਨੂੰ ਪਾਣੀ ਦੀ ਹੀ ਲੋੜ ਹੁੰਦੀ ਹੈ ਘਰ ਦਾ ਹਰ ਇੱਕ ਕੰਮ ਪਾਣੀ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ ਸਫਾਈਆਂ ਕਰਨੀਆਂ ਕੱਪੜੇ ਧੋਣੇ ਹਰ ਇੱਕ ਕੰਮ 'ਚ ਪਾਣੀ ਦੀ ਸਾਨੂੰ ਲੋੜ ਹੁੰਦੀ ਹੈ ਔਰ ਰਸੋਈ ਘਰ ਵਿੱਚ ਖਾਣਾ ਬਣਾਉਣ ਵਾਸਤੇ ਵੀ ਸਾਨੂੰ ਪਾਣੀ ਦੀ ਹੀ ਲੋੜ ਹੁੰਦੀ ਹੈ ਪਾਣੀ ਤੋਂ ਬਿਨਾ ਤਾਂ ਅਸੀਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਔਰ ਪਾਣੀ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੋ ਗਈ ਹੈ ਅਸੀਂ ਪ੍ਰਯੋਗ ਕਰਨ ਦੇ ਨਾਲ ਨਾਲ ਕਈ ਵਾਰ ਪਾਣੀ ਨੂੰ ਵਿਅਰਥ ਵੀ ਬੜਾ ਕਰਦੇ ਹਾਂ ਉਹਨੂੰ ਵੇਸਟ ਬਹੁਤ ਜ਼ਿਆਦਾ ਕਰਦੇ ਹਾਂ ਅਤੇ ਜਿਹੜਾ ਸਾਨੂੰ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਅਤੇ ਪਾਣੀ ਦੀ ਵਰਤੋਂ ਬੜੀ ਸਾਂਭ ਸੰਭਾਲ ਕੇ ਕਰਨੀ ਚਾਹੀਦੀ ਹੈ ਦਿਨ ਦੌਰਾਨ ਵੱਖ ਵੱਖ ਤਰ੍ਹਾਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਅਤੇ ਜੇ ਅਗਰ ਵੇਖਿਆ ਜਾਵੇ ਤਾਂ ਇੱਕ ਬਿਜਲੀ ਉਤਪਾਦਨ ਵਾਸਤੇ ਵੀ ਪਾਣੀ ਦੀ ਹੀ ਲੋੜ ਹੁੰਦੀ ਹੈ ਉਹ ਵੀ ਇੱਕ ਦਿਨ ਚਰਿਆ ਦਾ ਕੰਮ ਹੀ ਹੈ ਕਿ ਪਾਣੀ ਤੋਂ ਬਿਜਲੀ ਦਾ ਉਤਪਾਦਨ ਵੀ ਹੁੰਦਾ ਹੈ ਅਤੇ ਉਸ ਬਿਜਲੀ ਨੂੰ ਅਸੀਂ ਵੀ ਆਪਣੇ ਘਰਾਂ 'ਚ ਪ੍ਰਯੋਗ ਕਰਦੇ ਹਾਂ ਅਤੇ ਉਹ ਵੀ ਇੱਕ ਅਪ੍ਰਤੱਖ ਰੂਪ ਦੇ ਵਿੱਚ ਸਾਨੂੰ ਪਾਣੀ ਦਾ ਹੀ ਉਹ ਵੀ ਪ੍ਰਯੋਗ ਹੁੰਦਾ ਹੈ ਅਤੇ ਪਾਣੀ ਹੀ ਇੱਕ ਐਸਾ ਸਾਧਨ ਹੈ ਜੋ ਸਾਨੂੰ ਜ਼ਿੰਦਗੀ ਜੀਣ ਵਿੱਚ ਸਹਾਇਤਾ ਕਰਦਾ ਹੈ ਅਗਰ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋਵੇ ਤਾਂ ਅਸੀਂ ਕੁਪੋਸ਼ਣ ਦੇ ਸ਼ਿਕਾਰ ਹੋ ਜਾਦੇ ਹਾਂ ਜ਼ਿੰਦਗੀ ਦੀ ਪੂਰੇ ਦਿਨ ਵਿੱਚ ਸਾਨੂੰ ਜਿੰਨਾ ਪਾਣੀ ਪੀਣਾ ਚਾਹੀਦਾ ਹੈ ਸੱਤ ਤੋਂ ਅੱਠ ਗਿਲਾਸ ਪਾਣੀ ਪੀਣੇ ਚਾਹੀਦੇ ਹਨ ਅਤੇ ਉਹ 'ਤੇ ਵੀ ਸਾਡਾ ਜ਼ਿੰਦਗੀ ਉਹ 'ਤੇ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ ਅਤੇ ਇਸ ਕਰਕੇ ਸਾਨੂੰ ਪਾਣੀ ਦੀ ਬਹੁਤ ਲੋੜ ਹੈ ਅਤੇ ਸਾਨੂੰ ਇਸਦਾ ਪ੍ਰਯੋਗ ਵੀ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ